ਜੈਵ ਵਿਭਿੰਨਤਾਂ ਸਾਡੇ ਬਾਗਾਂ ਦੇ ਵਿੱਚ ਬਹੁਤ ਬੜੀ ਭੂਮਿਕਾ ਨਿਭਾਉਂਦੇ ਹਨ ਜਿਵੇਂ ਕਿ ਇਹ ਇੱਕ ਕੁਦਰਤੀ ਚੱਕਰ ਨੂੰ ਪੂਰਾ ਕਰਦੇ ਹਨ ਫੁੱਲਾਂ ਤੋ ਫਲ ਬਣਾ ਦਿੰਦੇ ਹਨ ਅਤੇ ਫੁੱਲਾਂ ਦੇ ਵਿੱਚੋਂ ਹੀ ਰਸ ਕੱਢ ਕੇ ਸ਼ਹਿਦ ਬਣਾ ਦਿੰਦੇ ਹਨ ਅਤੇ ਇਸ ਤਰ੍ਹਾਂ ਸਾਡੇ ਬਾਗਾਂ ਦੇ ਵਿੱਚ ਇੱਕ ਬਹੁਤ ਬੜੀ ਕ੍ਰਿਆ ਇਨ੍ਹਾਂ ਦੇ ਥਰੂ ਹੀ ਪੂਰੀ ਹੁੰਦੀ ਹੈ ਇਸ ਨੂੂੰ ਉਤਸ਼ਾਹਿਤ ਕਰਨ ਵਾਸਤੇ ਸਾਨੂੰ ਹਵਾ ਪਾਣੀ ਅਤੇ ਮਿੱਟੀ ਦਾ ਬਚਾਉਣਾ ਬਹੁਤ ਜ਼ਰੂਰੀ ਹੈ ਸਾਨੂੰ ਪ੍ਰਦੂਸ਼ਿਤ ਹਵਾ ਨਹੀਂ ਹੋਣੀ ਚਾਹੀਦੀ ਜਿੱਦਾਂ ਕਿ ਗੈਸ ਵਾਲੀਆਂ ਫੈਕਟਰੀਆਂ ਦਾ ਪ੍ਰਦੂਸ਼ਣ ਹੋ ਗਿਆ ਗੰਦੇ ਪਾਣੀ ਦਾ ਹੋ ਗਿਆ ਔਰ ਜਿਹੜੀ ਮਿੱਟੀ ਹੈ ਮਿੱਟੀ ਦੇ ਉੱਤੇ ਅਸੀਂ ਜਿਹੜੀ ਕੈਮੀਕਲ ਦੀਆਂ ਸਪਰੇਹਾਂ ਕਰ ਕਰਕੇ ਮਿੱਟੀ ਨੂੰ ਜ਼ਹਿਰੀਲਾ ਕਰੀ ਜਾਂਦੇ ਹੈ ਉਸਦੇ ਨਾਲ ਇਨ੍ਹਾਂ ਜੈਵ ਦੇ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ ਅਤੇ ਸਾਨੂੰ ਇਨ੍ਹਾਂ ਦੀ ਰੱਖਿਆ ਕਰਨ ਵਾਸਤੇ ਜਿਹਦੇ ਕੁਦਰਤੀ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿੱਦਾਂ ਗੋਹੇ ਵਾਲੀ ਖਾਦ ਹੋ ਗਈ ਔਰ ਸਾਫ਼ ਪਾਣੀ ਵਰਤਣਾ ਚਾਹੀਦਾ ਹੈ ਅਤੇ ਸਾਨੂੰ ਜਗ੍ਹਾ ਜਗ੍ਹਾ ਬੂਟੇ ਲਾਣੇ ਚਾਹੀਦੇ ਹਨ ਅਤੇ ਜਿੱਦਾਂ ਬੂਟੇ ਲਾਉਂਗੇ ਉਹਦੇ ਨਾਲ ਸਾਡੀ ਹਵਾ ਵੀ ਸਾਫ ਸੁਥਰੀ ਹੋ ਜੇਗੀ ਛੋਟੇ ਛੋਟੇ ਟੋਭੇ ਬਣਾ ਦੇਣੇ ਚਾਹੀਦੇ ਹਨ ਬਹੁਤੇ ਵੱਡੇ ਟੋਭੇ ਨਹੀਂਂ ਬਣਾ ਸਕਦੇ ਤਾਂ ਵੀ ਕੋਈ ਗੱਲ ਨਹੀਂ ਮੈਂ ਦੇਖਿਆ ਵੀ ਕਿਤੇ ਛੋਟੇ ਛੋਟੇ ਖੱਡੇ ਹੁੰਦੇ ਹਨ ਅਤੇ ਉੱਥੇ ਪਾਣੀ ਬਰਸਾਤ ਦਾ ਪਾਣੀ ਹੋ ਗਿਆ ਉਹਦੇ ਨਾਲ ਕੀ ਹੁੰਦਾ ਹੈ ਛੋਟੇ ਛੋਟੇ ਜੀਵ ਜੰਤੂ ਪੈਦਾ ਹੁੰਦੇ ਹੈ ਉਹ ਕੁਦਰਤੀ ਚੱਕਰ ਨੂੰ ਪੂਰਾ ਕਰਦੇ ਹਨ ਅਤੇ ਇਸ ਤਰ੍ਹਾਂ ਆਪਣਾ ਬਾਗ਼ ਦੇ ਵਿੱਚ ਇਹ ਜੈਵ ਵਿੰਭਿਨਤਾ ਹੈ ਜਿਹੜੀ ਕੁਦਰਤੀ ਚੱਕਰ ਨੂੰ ਪੂਰਾ ਕਰਦੀ ਰਹਿੰਦੀ ਹੈ